ਹੈਲੋ ਹੈਲੋ ਕਿਵੇਂ ਆ ਵਧੀਆ ਮੈਂ ਵੀ ਤੁਸੀਂ ਦਸੋ ਕੀ ਕਰਦੇ ਸੀ ਅੱਛਾ ਅੱਛਾ ਹਾਂ ਟੀਚਰ ਤਾਂ ਬੜੇ ਕੋਪਰੇਟਿਵ ਹੈਗੇ ਆ ਬਹੁਤ ਜ਼ਿਆਦਾ ਵਧੀਆ ਹੈਗੇ ਲੈਕਚਰ ਵੀ ਵਧੀਆ ਲੱਗਦੇ ਹੈਗੇ ਆ ਰਣਜੀਤ ਸਰ ਬਹੁਤ ਵਧੀਆ ਪੜ੍ਹਾਉਂਦੇ ਆ ਹਾਂ ਆਪਣੇ ਰ ਹਾਂ ਆਪਣੇ ਰੈਗੂਲਰ ਸੈਮੀਨਾਰ ਲੱਗਦੇ ਰਹਿੰਦੇ ਆ ਆਪਾਂ ਨੂੰ ਚੰਗੀ ਤਰ੍ਹਾਂ ਗਾਈਡ ਕਰਦੇ ਹੈਗੇ ਆ ਹਾਂ ਤੁਸੀਂ ਅੱਜ ਕਾਲਜ ਗਏ ਸੀਗੇ ਅੱਛਾ ਅੱਜ ਵੀ ਸੈਮੀਨਾਰ ਹੀ ਲੱਗਿਆ ਸੀ ਅੱਛਾ ਕੀ ਦੱਸਿਆ ਓਹਦੇ 'ਚ ਅੱਛਾ ਠੀਕ ਆ ਠੀਕ ਆ ਹਾਂ ਹੁੰ ਹਾਂ ਫ਼ੈਸਿਲੀਟੀ ਤਾਂ ਵਧੀਆ ਹੈਗੀ ਆ ਸਿਟਿੰਗ ਅਰੇਜਮੇਂਟ ਕਿੰਨਾ ਵਧੀਆ ਹੈਗਾ ਆ ਵਾਟਰ ਦੀ ਫ਼ੈਸਿਲੀਟੀ ਵੀ ਕਿੰਨੀ ਵਧੀਆ ਹੈਗੀ ਆ ਜਨਰੇਟਰ ਵੀ ਲੱਗਿਆ ਹੈਗਾ ਵੱਡਾ ਹੂੰ ਗੇਮਸ ਲਈ ਕਿੰਨੀ ਅਪੋਰਚਨਿਟੀ ਹੈਗੇ ਆ ਹੂੰ ਆਪਣਾ ਗਰਾਊਂਡ ਕਿੰਨਾ ਵੱਡਾ ਹੈਗਾ ਗਰਾਊਂਡ ਕਿੰਨਾ ਵੱਡਾ ਹੈਗਾ ਉੱਥੇ ਜਿਹੜੀ ਮਰਜੀ ਚੀਜ਼ ਖੇਡੀ ਜਾਵੇ ਹੂੰ ਹੂੰ ਹੈਲਪਫੁਲ ਹੈਗੇ ਆ ਪਰ ਉਹ ਟੈਸਟ ਬਾਰੇ ਦੱਸਤਾ ਸੀ ਨਾ ਇੰਟਰੈਂਸ ਟੈਸਟ ਹੁੰਦਾ ਹੁੰਦਾ ਜਿਹੜਾ ਅੱਛਾ ਭੇਜ ਤਾ ਸੀਗਾ ਠੀਕ ਆ ਹਾਂ ਕਿਵੇਂ ਅੱਛਾ ਹਾਂ ਇੰਟਰੈਂਸ ਟੈਸਟ ਤਾਂ ਠੀਕ ਹੀ ਹੁੰਦਾ ਮਤਲਬ ਕਿ ਐਵਰੇਜ ਕੁਐਸ਼ਨ ਦੇ ਹੁੰਦੇ ਇੰਨੇ ਡਿਫੀਕਲਟ ਨਹੀਂ ਹੁੰਦੇ ਆਪਣੀ ਬੇਸਿਕ ਨੋਲੇਜ ਹੀ ਟੈਸਟ ਕਰਦੇ ਹੈ ਚਲ ਫਿਰ ਮੈਨੂੰ ਘਰ ਵਾਲੇ ਬੁਲਾਉਂਦੇ ਨੇ ਮੈਂ ਬਾਅਦ 'ਚ ਗੱਲ ਕਰਾਂਗਾ ਚੰਗਾ ਚੰਗਾ